ਮੇਰੀ ਇੱਕ ਮਨਪਸੰਦ ਕਿਤਾਬ ਤੁਲਸੀ ਜੀ ਦੀ ਕਿਤਾਬ ਹੈ ਜੋ ਪੰਜਾਬੀ ਵਿੱਚ ਲਿਖੀ ਗਈ ਹੈ ਅਤੇ ਹਿੰਦੂ ਧਰਮ ਦੇ ਉੱਪਰ ਅਧਾਰਿਤ ਹੈ ਅਤੇ ਇਹ ਕਿਤਾਬ ਮੈਨੂੰ ਪੂਰੇ ਪੰਜਾਬ ਵਿੱਚ ਮੈਂ ਟਰਾਈ ਕੀਤਾ ਮੈਨੂੰ ਨਹੀਂ ਮਿਲੀ ਅਤੇ ਬਹੁਤ ਜੱਦੋ ਜਹਿਦ ਤੋਂ ਬਾਅਦ ਮੈਂ ਇੱਕ ਦਿੱਲੀ ਦੇ ਵਿੱਚ ਇੱਕ ਬੁਕਸ ਮੇਲਾ ਲੱਗਿਆ ਅਤੇ ਉਸਦੇ ਵਿੱਚ ਉੱਥੇ ਮੇਰਾ ਇੱਕ ਦੋਸਤ ਨੂੰ ਮੈਂ ਕਿਹਾ ਕਿ ਤੁਸੀਂ ਉੱਥੇ ਉਹ ਕਿਤਾਬ ਪਤਾ ਕਰੋ ਅਤੇ ਉਸਨੇ ਉਹ ਕਿਤਾਬ ਉੱਥੇ ਪਤਾ ਕੀਤੀ ਅਤੇ ਕੁਦਰਤੀ ਉੱਥੇ ਉਹ ਕਿਤਾਬ ਉਹਨੂੰ ਮਿਲ ਗਈ ਅਤੇ ਉਹ ਕਿਤਾਬ ਮੇਰੀ ਬਹੁਤ ਮਨ ਪਸੰਦ ਹੈ ਉੱਥੋਂ ਮੈਂ ਮੰਗਵਾਈ ਅਤੇ ਉਸਨੂੰ ਮੈਂ ਰੋਜ਼ ਪੜ੍ਹਦਾ ਹਾਂ ਅਤੇ ਮੈਨੂੰ ਉਹ ਕਿਤਾਬ ਪੜ੍ਹਨਾ ਬਹੁਤ ਪਸੰਦ ਹੈ ਅਤੇ ਉਹ ਕਿਤਾਬ ਨੂੰ ਮੈਂ ਬਹੁਤ ਸੰਭਾਲ ਕੇ ਰੱਖਦਾ ਹਾਂ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ ਮੈਂ ਉਹਦਾ ਕੁਛ ਪਾਟ ਪੜ੍ਹਦਾ ਹਾਂ ਅਤੇ ਉਸ ਕਿਤਾਬ ਨੂੰ ਮੇਰੇ ਤੋਂ ਇਲਾਵਾ ਹੋਰ ਕੋਈ ਹੱਥ ਨਹੀਂ ਲਾਉਂਦਾ ਅਤੇ ਉਸਨੂੰ ਮੈਨੂੰ ਉਹ ਕਿਤਾਬ ਪੜ੍ਹਨਾ ਬਹੁਤ ਪਸੰਦ ਹੈ ਅਤੇ ਮੈਂ ਬਹੁਤ ਸੰਭਾਲ ਨਾਲ ਰੱਖਦਾ ਉਸ ਕਿਤਾਬ ਨੂੰ ਅਤੇ ਉਹ ਮੇਰੀ ਬਹੁਤ ਮਨਪਸੰਦ ਕਿਤਾਬ ਹੈ